ਮੈਨੂੰ ਟਰੈਵਲਿੰਗ ਦਾ ਬਹੁਤ ਹੀ ਸ਼ੌਂਕ ਹੈ ਮੈਂ ਅਕਸਰ ਘੁੰਮਣ ਜਾਂਦੀ ਰਹਿੰਦੀ ਹਾਂ ਮੈਨੂੰ ਸਮੁੰਦਰ ਪਹਾੜ ਅਤੇ ਧਾਰਮਿਕ ਸਥਾਨ ਜਿਵੇਂ ਕਿ ਗੁਰਦੁਆਰੇ ਜਾਣਾ ਬਹੁਤ ਹੀ ਵਧੀਆ ਲੱਗਦਾ ਹਜੇ ਕੱਲ੍ਹ ਹੀ ਮੈਂ ਗੁਰਦੁਆਰੇ ਗਈ ਤਰਨ ਤਾਰਨ ਦੇ ਗੁਰਦੁਆਰੇ ਦਾ ਸਰੋਵਰ ਬਹੁਤ ਹੀ ਵੱਡਾ ਹੈ ਜਦ ਮੈਂ ਗੁਰਦੁਆਰੇ ਜਾਂਦੀ ਹਾਂ ਤਾਂ ਮੇਰੇ ਮਨ ਨੂੰ ਬੜੀ ਹੀ ਸ਼ਾਂਤੀ ਮਿਲਦੀ ਹੈ ਮੇਰੀ ਸਾਰੀ ਟੈਂਸ਼ਨ ਦੂਰ ਹੋ ਜਾਂਦੀ ਹੈ ਮੈਂ ਜਦੋਂ ਵੀ ਕੋਈ ਆਪਣੀ ਇੱਛਾ ਪ੍ਰਗਟ ਕਰਦੀ ਹਾਂ ਤਾਂ ਮੇਰੀ ਜਲਦੀ ਹੀ ਪੂਰੀ ਹੋ ਜਾਂਦੀ ਹੈ ਜਦੋਂ ਗੁਰਦੁਆਰੇ ਮੱਥਾ ਟੇਕਦੇ ਹਾਂ ਅਸੀਂ ਉੱਥੋਂ ਦਾ ਪ੍ਰਸ਼ਾਦ ਖਾਂਦੇ ਹਾਂ ਅਤੇ ਲੰਗਰ ਛੱਕਦੇ ਹਾਂ ਸਾਡੇ ਮਨ ਨੂੰ ਅਲੱਗ ਜਿਹੀ ਹੀ ਸ਼ਾਂਤੀ ਮਿਲਦੀ ਹੈ ਜਿਹੜੀ ਕਿਤੇ ਵੀ ਨਹੀਂ ਮਿਲਦੀ ਸਾਡੀਆਂ ਸਾਰੀਆਂ ਟੈਂਸ਼ਨਸ ਦੂਰ ਹੋ ਜਾਂਦੀਆਂ ਹਨ ਅਤੇ ਜਦੋਂ ਮੈਂ ਕਿਸੇ ਪਹਾੜੀ ਜਗ੍ਹਾ 'ਤੇ ਜਾਵਾਂ ਜਿਵੇਂ ਕਿ ਮੈਂ ਪਿਛਲੇ ਸਾਲ ਹੀ ਸ਼ਿਮਲਾ ਗਈ ਸੀ ਉੱਥੋਂ ਦੇ ਨੇਚਰ ਨਾਲ ਜਦੋਂ ਮੈਂ ਇੰਟਰੈਕਟ ਕੀਤਾ ਤਾਂ ਮੇਰੇ ਮਨ 'ਤੇ ਅਲੱਗ ਹੀ ਪ੍ਰਭਾਵ ਪਿਆ ਮੈਨੂੰ ਬੜੀ ਹੀ ਸ਼ਾਂਤੀ ਮਿਲੀ ਜਦੋਂ ਮੈਂ ਪੰਛੀਆਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਾ ਇਸ ਕਰਕੇ ਮੈਨੂੰ ਸਮੁੰਦਰ ਜਾਂ ਪਹਾੜ ਜਾਂ ਕਿਤੇ ਧਾਰਮਿਕ ਸਥਾਨ 'ਤੇ ਜਾਣਾ ਬਹੁਤ ਹੀ ਵਧੀਆ ਲੱਗਦਾ